ਸੁਰ ਲੈਅ ਅਤੇ ਤਾਲਬੱਧ ਸ਼ਬਦਾਂ ਦੇ ਸੁੰਦਰ ਸਮੂਹ ਨੂੰ ਗੀਤ ਕਿਹਾ ਜਾਂਦਾ ਹੈ ਗਾਉਣ ਵਿੱਚ ਮੇਰੀ ਸੰਗੀਤ ਦੀ ਪਸੰਦੀਦਾ ਸ਼ੈਲੀ ਹੈ ਟੱਪੇ ਖਿਆਲ ਵਾਲੇ ਗੀਤ ਅਤੇ ਫੋਕ ਗੀਤ ਜਿਨ੍ਹਾਂ ਨੂੰ ਕਹਿ ਦਿੰਦੇ ਨੇ ਉਹ ਮੈਨੂੰ ਜ਼ਿਆਦਾ ਪਸੰਦ ਆਉਂਦੇ ਨੇ ਕਿਉਂਕਿ ਦੇਖਿਆ ਜਾਵੇ ਕਿ ਫੋਕ ਗੀਤ ਹੋ ਗਏ ਜਾਂ ਟੱਪੇ ਹੋ ਗਏ ਇਹ ਮੇਰੀ ਆਵਾਜ਼ ਦੇ ਨਾਲ ਮਤਲਬ ਕਾਫੀ ਸੰਯੋਗ ਕਾਫੀ ਵਧੀਆ ਸਿੱਧ ਹੁੰਦੇ ਨੇ ਮੈਨੂੰ ਲੱਗਦਾ ਮੇਰੀ ਆਵਾਜ਼ ਇਨ੍ਹਾਂ ਦੇ ਇਨ੍ਹਾਂ ਦੇ ਲਈ ਬਣੀ ਹੈ ਤਾਂ ਇਸ ਲਈ ਮੈਂ ਟੱਪੇ 'ਤੇ ਹੋ ਗਿਆ ਇਸ ਤੋਂ ਇਲਾਵਾ ਫੋਕ ਗੀਤ ਜ਼ਿਆਦਾਤਰ ਗਾਉਣਾ ਆਪਣੀ ਆਵਾਜ਼ ਦੇ ਨਾਲ ਪਸੰਦ ਕਰਦਾ